ਹਾਂਜੀ ਮੈਂ ਹਾਲ ਹੀ ਆਨਲਾਈਨ ਐਪਸੀ ਐਪ ਤੋਂ ਖਰੀਦਦਾਰੀ ਕੀਤੀ ਸੀ ਅਤੇ ਮੈਂ ਉਸ ਐਪ ਤੋਂ ਇੱਕ ਕਰੋਕਰੀ ਦਾ ਸੈਟ ਖਰੀਦਿਆ ਸੀ ਅਤੇ ਮੇਰਾ ਅਨੁਭਵ ਬਹੁਤ ਹੀ ਵਧੀਆ ਰਿਹਾ ਆਨਲਾਈਨ ਘਰ ਬੈਠੇ ਹੀ ਮੈਨੂੰ ਮੇਰਾ ਮਨ ਪਸੰਦ ਡਿਜਾਇਨ ਅਤੇ ਬ੍ਰਾਂਡ ਦੀ ਚੀਜ਼ ਮਿਲ ਗਈ ਆਨਲਾਈਨ ਖਰੀਦਦਾਰੀ ਕਰਨ ਦਾ ਸਭ ਤੋਂ ਵੱਡਾ ਲਾਭ ਇਹ ਹੈ ਕਿ ਤੁਹਾਨੂੰ ਹਰ ਚੀਜ਼ ਮਿਲ ਜਾਂਦੀ ਹੈ ਤੁਹਾਡੀ ਪਸੰਦ ਦੀ ਰੰਗਾ ਦੀ ਡਿਜ਼ਾਇਨ ਦੀ ਅਤੇ ਵੱਖ ਵੱਖ ਅਕਾਰਾਂ ਦੀ ਜੋ ਕਿ ਆਮ ਬਾਜ਼ਾਰਾਂ ਦੇ ਵਿੱਚ ਜ਼ਿਆਦਾ ਤੌਰ 'ਤੇ ਉਪਲਬਧ ਨਹੀਂ ਹੁੰਦੀ ਘਰ ਬੈਠੇ ਖਰੀਦਦਾਰੀ ਕਰਨਾ ਸਭ ਤੋਂ ਵੱਡਾ ਫ਼ਾਇਦਾ ਹੈ ਤੁਸੀਂ ਵੱਖ ਵੱਖ ਚੀਜ਼ਾਂ ਦੀ ਕੀਮਤਾਂ ਦੀ ਤੁਲਨਾ ਕਰ ਸਕਦੇ ਹੋ ਅਤੇ ਆਪਣੇ ਵਾਸਤੇ ਸਭ ਤੋਂ ਵਧੀਆ ਚੀਜ਼ ਖਰੀਦ ਸਕਦੇ ਹੋ ਸਾਡੇ ਆਪ ਚੱਲ ਕੇ ਬਾਜ਼ਾਰ ਜਾਣ ਦੀ ਪਰੇਸ਼ਾਨੀ ਤੋਂ ਵੀ ਬਚ ਸਕਦੇ ਹਨ ਆਨਲਾਈਨ ਅਕਸਰ ਚੀਜ਼ਾਂ 'ਤੇ ਸ਼ੋਟ ਚਲਦੀ ਰਹਿੰਦੀ ਹੈ ਜਿਸ ਕਰਕੇ ਜਦੋਂ ਮੈਂ ਆਪਣੀ ਕਰੋਕਰੀ ਖਰੀਦੀ ਸੀ ਮੈਨੂੰ ਮੇਰੀ ਮਨ ਪਸੰਦ ਕੀਮਤ ਅਤੇ ਡਿਜ਼ਾਇਨ 'ਤੇ ਮੇਰੀ ਕਰੋਕਰੀ ਮਿਲ ਗਈ ਅਤੇ ਮੇਰਾ ਆਰਡਰ ਵੀ ਟਾਈਮ ਸਿਰ ਪਹੁੰਚ ਗਿਆ ਉਹ ਵੀ ਸਹੀ ਹਾਲਤ ਵਿੱਚ ਮੇਰਾ ਤਾਂ ਅਨੁਭਵ ਬਹੁਤ ਹੀ ਵਧੀਆ ਰਿਹਾ ਅਤੇ ਮੈਂ ਆਪਣੇ ਜਿੰਨੇ ਵੀ ਮਿੱਤਰਾਂ ਔਰ ਸਹੇਲੀਆਂ ਨੂੰ ਆ ਹੀ ਸਲਾਹ ਦਿੰਦੀ ਹਨ ਕਿ ਇੱਦਾਂ ਦੀ ਚੀਜ਼ਾਂ ਨੂੰ ਆਨਲਾਈਨ ਖਰੀਦਣਾ ਹੀ ਬਿਹਤਰ ਰਹਿੰਦਾ ਹੈ